ਮੇਰਾ ਪਸੰਦੀਦਾ ਕਲਾਕਾਰ ਅਸਲ ਵਿੱਚ ਇੱਕ ਨਹੀਂ ਬਲਕਿ ਦੋ ਹਨ ਮੈਂ ਦਲਜੀਤ ਦੋਸਾਂਝ ਅਤੇ ਅਮਰਿੰਦਰ ਗਿੱਲ ਨੂੰ ਆਪਣਾ ਪਸੰਦੀਦਾ ਕਲਾਰ ਕਲਾਕਾਰ ਮੰਨਣਾ ਚਾਹੂੰਗਾ ਅਤੇ ਦਿਲਜੀਤ ਦੋਸਾਂਝ ਬਾਰੇ ਮੈਨੂੰ ਇਹ ਪਸੰਦ ਹੈ ਕਿ ਉਹ ਆਪਣਾ ਪੰਜਾਬੀ ਗੀਤਕਾਰ ਹੈ ਉਹ ਬਹੁਤ ਵਧੀਆ ਗਾਣੇ ਗਾਉਂਦੇ ਹਨ ਅਤੇ ਉਹਨਾਂ ਦੀਆਂ ਲਿਖਤ ਬਹੁਤ ਵਧੀਆ ਹੈਗੀ ਆ ਬਾਕੀ ਉਹਨਾਂ ਦਾ ਸੁਰ ਤਾਲ ਵਗੈਰਾ ਉਹਨਾਂ ਦੇ ਗਿਤ ਗਾਏ ਗਏ ਗੀਤ ਜਿੰਨੀ ਮਰਜ਼ੀ ਵਾਰ ਸੁਣੇ ਜਾਣ ਬੰਦਾ ਅੱਕਦਾ ਨਹੀਂ ਹੈ ਅਤੇ ਅਮਰਿੰਦਰ ਗਿੱਲ ਬਾਰੇ ਮੈਂ ਇਹ ਦੱਸਣਾ ਚਾਹੂੰਗਾ ਕਿ ਉਹ ਬਹੁਤ ਹੀ ਵਧੀਆ ਪੇਸ਼ਕਸ਼ ਕਰਦੇ ਹਨ ਉਹਨਾਂ ਦੇ ਦਿਲ ਤੋਂ ਗਾਉਂਦੇ ਹਨ ਉਹਨਾਂ ਦੀ ਲਿਖਤ ਇੰਨੀ ਸੋਹਣੀ ਹੈ ਕਿ ਬਸ ਬੰਦੇ ਦੇ ਰੂਹ ਖੁਸ਼ ਹੋ ਜਾਂਦੀ ਉਹਨਾਂ ਦਾ ਗੀਤ ਸੁਣ ਕੇ